ਭਾਸ਼ਾ ਦਾ ਮਸਲਾ ਇਹ ਇੰਨਾ ਪੁਰਾਣਾ ਹੈ ਜਿੰਨੀ ਪੁਰਾਣੀ ਕੋਈ ਸੱਭਿਅਤਾ ਹੋਵੇ ਜਿਵੇਂ ਸਾਡੇ ਪੰਜਾਬ ਦੇ ਵਿੱਚ ਪੰਜਾਬੀ ਕਿਵੇਂ ਸ਼ੁਰੂ ਹੋਈ ਪੰਜਾਬੀ ਨੂੰ ਬਦਲਦਿਆਂ ਬਦਲਦਿਆਂ ਅੱਜ ਦਾ ਜੋ ਰੂਪ ਹੈ ਇਹ ਇੱਥੋਂ ਤੱਕ ਕਿਵੇਂ ਆਇਆ ਇਹ ਸਾਰਾ ਕੁਛ ਜੀ ਜੇ ਗੱਲ ਕਰਨੀ ਹੋਵੇ ਤਾਂ ਇੱਕ ਬਹੁਤ ਲੰਬਾ ਚੌੜਾ ਸਮਾਂ ਸਾਨੂੰ ਚਾਹੀਦਾ ਹੋਊਗਾ ਪਰ ਅੱਜ ਦੇ ਸਮੇਂ 'ਚ ਜਿਵੇਂ ਰੇਡੀਓ ਟੈਲੀਵਿਜ਼ਨ ਜਾਂ ਸੋਸ਼ਲ ਮੀਡੀਆ ਦੇ ਉੱਤੇ ਪੰਜਾਬੀ ਦੇ ਕਾਫੀ ਰੁਝਾਨ ਚੱਲਦੇ ਆ ਉਹਨਾਂ ਵਿੱਚ ਪੰਜਾਬੀ ਨਾ ਤਾਂ ਸਾਫ ਲਿਖੀ ਹੁੰਦੀ ਹੈ ਅਤੇ ਨਾ ਠੀਕ ਢੰਗ ਨਾਲ ਬੋਲੀ ਜਾਂਦੀ ਹੈ ਉਂਝ ਪੰਜਾਬੀ ਨੇ ਬਹੁਤ ਸਾਰੀਆਂ ਹੋਰ ਭਾਸ਼ਾਵਾਂ ਦੇ ਅੱਖਰ ਆਪਣੇ ਵਿੱਚ ਓਬਜਰਵ ਕਰ ਲਏ ਹੈ ਅਤੇ ਉਹ ਇਸੇ ਤਰ੍ਹਾਂ ਰਵਾਨਗੀ ਦੇ ਵਿੱਚ ਬੋਲੇ ਜਾਂਦੇ ਆ ਜਿਵੇਂ ਅਸੀਂ ਪੰਜਾਬੀ ਹੀ ਬੋਲ ਰਹੇ ਹੋਈਏ ਖਾਸ ਕਰਕੇ ਜਿਵੇਂ ਮੈਂ ਹੁਣੇ ਓਬਜਰਵ ਸ਼ਬਦ ਵਰਤਿਆ ਤਾਂ ਇੱਥੇ ਮੈਨੂੰ ਕਹਿ ਦੇਣਾ ਚਾਹੀਦਾ ਸੀ ਕਿ ਜਜਬ ਕੀਤੇ ਇਸੇ ਤਰ੍ਹਾਂ ਜਦੋਂ ਅਸੀਂ ਸੋਸ਼ਲ ਮੀਡੀਆ 'ਤੇ ਵੀ ਕੋਈ ਲਿਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਈ ਵਾਰੀ ਉਹ ਸ਼ਬਦ ਨਿਕਲ ਨਹੀਂ ਰਹੇ ਹੁੰਦੇ ਜਿਵੇਂ ਬੋਲ ਕੇ ਕੋਈ ਅਸੀਂ ਕੱਢ ਰਹੇ ਹੁੰਦੇ ਹਾਂ ਪ੍ਰੋਫਾਈਲ ਜਾਂ ਕੋਈ ਅਸੀਂ ਦੇਖਣਾ ਚਾਹੁੰਦੇ ਹਾਂ ਕੋਈ ਵਿਸ਼ੇਸ਼ ਖਬਰ ਦੇ ਬਾਰੇ 'ਚ ਤਾਂ ਅਸੀਂ ਬੋਲਦੇ ਹਾਂ ਪੰਜਾਬੀ ਪਰ ਉਹਦਾ ਸਹੀ ਉੱਥੇ ਉਲੱਥਣ ਨਹੀਂ ਹੁੰਦਾ ਹੋਰ ਦੀ ਹੋਰ ਆਉਂਦਾ ਰਹਿੰਦਾ ਹੋਰ ਦੀ ਹੋਰ ਆਉਂਦਾ ਰਹਿੰਦਾ ਇਸ ਕਰਕੇ ਪੰਜਾਬੀ ਭਾਸ਼ਾ ਦੇ ਵਿੱਚ ਬਹੁਤ ਸਾਰੀਆਂ ਦਿੱਕਤਾਂ ਹੈਗੀਆਂ ਕਦੇ ਜ਼ਮਾਨਾ ਸੀ ਜਦੋਂ ਰੇਡੀਓ ਤੋਂ ਠੇਠ ਪੰਜਾਬੀ 'ਚ ਖਬਰਾਂ ਸੁਣਾਈਆਂ ਜਾਂਦੀਆਂ ਸੀ ਪੰਜਾਬੀ ਦੇ ਗਾਣੇ ਗੀਤ ਸੰਗੀਤ ਚੱਲਿਆ ਕਰਦੇ ਸੀ ਮੈਂ ਪੰਜਾਬੀ ਦੀਆਂ ਬਹੁਤ ਸਾਰੀਆਂ ਭਾਸ਼ਾਵਾਂ ਉਪ ਭਾਸ਼ਾਵਾਂ ਜਿਹਨਾਂ ਨੂੰ ਮੈਂ ਕਹਿ ਸਕਦਾ ਜਿਵੇਂ ਇੱਕ ਗੀਤ ਸੀ ਸਾਡੀ ਲੋਕ ਕਲਾਕਾਰ ਨਰਿੰਦਰ ਬੀਬਾ ਜੀ ਦਾ ਉਹਦੇ ਇੱਕ ਸੱਸੀ ਪੁੰਨੂ ਦੇ ਕਿੱਸੇ ਵਿੱਚ ਇੱਕ ਲਾਈਨ ਆਉਂਦੀ ਹੈ ਮੋਰਾ ਰਤਿਆ ਥਲਾਂ ਦੇ ਵਿੱਚ ਲੱਗਿਆ ਯਾਨੀ ਮੋਰਾ ਇੱਥੇ ਮੇਰਾ ਸ਼ਬਦ ਪੰਜਾਬੀ 'ਚ ਵਰਤਿਆ ਜਾ ਸਕਦਾ ਸੀ ਰੱਤਿਆ ਰਤ ਜਾਂ ਲਹੂ ਪਰ ਉਹ ਸਥਾਨਕ ਜਿੱਥੇ ਇਹ ਵਾਕਿਆ ਹੁੰਦਾ ਰ ਮਾਰੂਥਲ ਦੇ ਵਿੱਚ ਉੱਥੋਂ ਦੀ ਭਾਸ਼ਾ ਦੇ ਵਿੱਚ ਲਿਖਣਾ ਹੀ ਸੋਹਣਾ ਲੱਗਦਾ ਸੀ ਪਰ ਇਹਨੂੰ ਪੰਜਾਬੀ ਦੀ ਰੰਗਤ ਦਿੱਤੀ ਗਈ ਇਸ ਤਰ੍ਹਾਂ ਸਾਡੀ ਪੰਜਾਬੀ ਕੋਈ ਇੱਕ ਖਿੱਤੇ ਦੀ ਜਾਂ

ਪਲੈਟਫੋਰਮ ਆ ਰੇਡੀਓ ਟੀ ਵੀ ਵਗੈਰਾ ਉਹਨਾਂ ਦੇ ਉੱਤੇ ਪਰਫੋਰਮੈਂਸ ਦੇ ਸਮੇਂ ਸ਼ੁੱਧਤਾ ਵੱਲ ਨੂੰ ਬਹੁਤ ਵੱਡਾ ਧਿਆਨ ਦੇਣ ਦੀ ਲੋੜ ਹੈ